ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ ਸਥਾਨ ਹੈ ਸਿੱਖ ਰਾਜ ਵਿੱਚ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਇਹਨ ਅੰਮ੍ਰਿਤਸਰ ਦੀ ਨੀਂਹ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖਾਂ ਦੇ ਚੌਥੇ ਗੁਰੂ ਜੀ ਨੇ ਰੱਖੀ ਸੀ ਪੰਦਰਾਂ ਏਸ ਈਸਵੀ ਵਿੱਚ ਉਹਨਾਂ ਨੇ ਇਸ ਅੰਮ੍ਰਿਤਸਰ ਵਿਖੇ ਇੱਕ ਸਰੋਵਰ ਦੀ ਸਥਾਪਨਾ ਕੀਤੀ ਸੀ ਅੰਮ੍ਰਿਤਸਰ ਵਿੱਚ ਚਾਰ ਦਰਵਾਜ਼ੇ ਹਨ ਜਿਸ ਦਾ ਮਤਲਬ ਹੈ ਕਿ ਉੱਥੇ ਹਰੇਕ ਧਰਮ ਦੇ ਲੋਕ ਜਾ ਰਹੇ ਹਨ ਜਾ ਸਕਦੇ ਹਨ ਜਿਵੇਂ ਕਿ ਸਿੱਖ ਇਸਾਈ ਮੁਸਲਮਾਨ ਆਦਿ ਉੱਥੇ ਜਾਣ ਦੀ ਕਿਸੇ ਨੂੰ ਵੀ ਮਨਾਹੀ ਨਹੀਂ ਹੈ ਅੰਮ੍ਰਿਤਸਰ ਦੀ ਇੱਕ ਹੋਰ ਮਹੱਤਤਾ ਹੈ ਉਸ ਉੱਥੇ ਹਰੇਕ ਸਮੇਂ ਚੋਂ ਲੰਗਰ ਚੱਲਦਾ ਰਹਿੰਦਾ ਹੈ ਅਤੇ ਲੰਗਰ ਹਾਲ ਵਿੱਚ ਬਹੁਤ ਜ਼ਿਆਦਾ ਵੱਡੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ ਅੰਮ੍ਰਿਤਸਰ ਦੇ ਸਰੋਵਰ ਵਿੱਚ ਨਹਾਉਣ ਨਾਲ ਲੋਕਾਂ ਦੇ ਦੁੱਖ ਅਤੇ ਦਰਦ ਦੂਰ ਹੋ ਜਾਂਦੇ ਹਨ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਆਉਂਦੇ ਹਨ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਉੱਥੇ ਜਾ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਮੈਂ ਵੀ ਉੱਥੇ ਬਹੁਤ ਵਾਰ ਗਈ ਹਾਂ ਬਲਕਿ ਮੈਂ ਬਚਪਨ ਤੋਂ ਹੀ ਅੰਮ੍ਰਿਤਸਰ ਜਾਂਦੀ ਰਹੀ ਹਾਂ ਕਿਉਂਕਿ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਮੈਂ ਅਤੇ ਮੇਰੀ ਫੈਮਿਲੀ ਸਾਲ ਵਿੱਚ ਦੋ ਵਾਰ ਅੰਮ੍ਰਿਤਸਰ ਜਾਂਦੇ ਹਾਂ ਕਿਉਂਕਿ ਅਸੀਂ ਹਰੇਕ ਵਾਰ ਕੋਈ ਵੀ ਸੁੱਖ ਸੁੱਖਦੇ ਹਾਂ ਤਾਂ ਉੱਥੇ ਪੂਰੀ ਕਰਨ ਲਈ ਜਾਂਦੇ ਹਾਂ ਉੱਥੇ ਜਾ ਕੇ ਸਾਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਅਸੀਂ ਉੱਥੇ ਜਾਂਦੇ ਹਾਂ ਉੱਥੋਂ ਦਾ ਇੱਕ ਮਹੱਤਵਪੂਰਨ ਬਜ਼ਾਰ ਹੈ ਜਿਸ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਖਰੀਦਦੇ ਹਾਂ ਜਿਸ ਦਾ ਨਾਮ ਗੁਰੂ ਕਾ ਬਜ਼ਾਰ ਹੈ ਅਸੀਂ ਲੰਗਰ ਉੱਥੇ ਲੰਗਰ ਵੀ ਛਕਦੇ ਹਾਂ ਕਿਉਂਕਿ ਲੰਗਰ ਉੱਥੋਂ ਦਾ ਲੰਗਰ ਛਕ ਕੇ ਸਾਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਅਸੀਂ ਸਰੋਵਰ ਵਿੱਚ ਇਸ਼ਨਾਨ ਵੀ ਕਰਦੇ ਹਾਂ ਅੰਮ੍ਰਿਤਸਰ ਦਾ ਪ੍ਰਸਾਰਨ ਲਾਈਵ ਚੱਲਦਾ ਹੈ ਜਿਸ ਨੂੰ ਲੋਕ ਘਰ ਬੈਠੇ ਵੀ ਲਾਈਵ ਦੇਖ ਸਕਦੇ ਹਨ ਜੋ ਕਿ ਲੋਕਾਂ ਨੂੰ ਅੰਮ੍ਰਿਤਸਰ ਦੇ ਲਾਈਵ ਦਰਸ਼ਨ ਕਰਵਾਉਂਦਾ ਹੈ ਮੀਡੀਆ ਹਰੇਕ ਵਾ ਸਮੇਂ ਉੱਥੇ ਮੌਜੂਦ ਰਹਿੰਦਾ ਹੈ ਧੰਨਵਾਦ